ਮੱਛੀਆਂ ਫੜ੍ਹਨ ਵਾਲੇ ਬਹੁਤੀ ਸਾਂਭ ਸੰਭਾਲ ਨਹੀਂ ਰੱਖਦੇ ਕਿਉਂਕਿ ਜਦੋਂ ਇਹ ਦੁਕਾਨਾਂ ਪਰ ਵੇਚਦੇ ਹੈ ਤਾਂ ਉੱਥੇ ਬਦਬੂ ਬਹੁਤ ਮਾਰਦੀ ਹੈ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ ਪਾਣੀ ਦਾ ਪ੍ਰਦੂਸ਼ਣ ਵੀ ਅੱਜ ਕੱਲ੍ਹ ਬਹੁਤ ਫੈਲਿਆ ਹੋਇਆ ਹੈ